ਭੰਗੜਾ ਇੱਕ ਪੰਜਾਬੀ ਲੋਕ ਨਾਚ ਹੈ ਭੰਗੜੇ ਨਾਲ ਸਾਰੇ ਪੰਜਾਬੀ ਬਹੁਤ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਭੰਗੜਾ ਇੱਕ ਬਹੁਤ ਵਧੀਆ ਐਕਸਰਸਾਈਜ਼ ਵੀ ਹੈ ਭੰਗੜੇ ਨੂੰ ਕਰਨ ਨਾਲ ਬਹੁਤ ਜ਼ਿਆਦਾ ਕੈਲਰੀਜ ਵੀ ਬਰਨ ਹੁੰਦੀਆਂ ਹਨ ਇਸ ਕਰਕੇ ਭੰਗੜਾ ਪ੍ਰਤਿਭਾਗੀਆਂ ਵਿੱਚ ਵਿਸਨਾਤਮਕ ਨੂੰ ਪ੍ਰੇਰਿਤ ਕਰਦਾ ਹੈ